ਪਹਿਲਾਂ ਮੇਰੇ ਕੋਲ ਜੀਓ ਵਾਲਾ ਬਟਨਾਂ ਵਾਲਾ ਫੋਨ ਹੁੰਦਾ ਸੀ ਅਤੇ ਉਹ ਫੋਨ ਸਿਰਫ ਕੋਲ ਕਰਨ ਲਈ ਹੀ ਯੂਜ ਹੁੰਦਾ ਸੀ ਅਤੇ ਹੌਲੀ ਹੌਲੀ ਉਹਦੇ ਵਿੱਚ ਵੱਟਸਅੱਪ ਸਿੰਪਲ ਵੱਟਸਅੱਪ ਵੀ ਚੱਲ ਪਿਆ ਸੀ ਪਰ ਜਦੋਂ ਕੋਵਿਡ ਹੋਇਆ ਉਦੋਂ ਸ ਘਰਦਿਆਂ ਨੇ ਸਮਾਰਟ ਫੋਨ ਲੈ ਕੇ ਦੇ ਦਿੱਤਾ ਕਿਉਂਕਿ ਔਨਲਾਈਨ ਕਲਾਸਿਸ ਲੱਗਦੀਆਂ ਸੀ ਅਤੇ ਸਮਾਰਟ ਫੋਨ ਦੀ ਜ਼ਰੂਰਤ ਸੀ ਅਤੇ ਘਰਦਿਆਂ ਨੇ ਫਿਰ ਉਹ ਫੋਨ ਲੈ ਕੇ ਦੇ ਦਿੱਤਾ ਅਤੇ ਉਹਦੇ 'ਤੇ ਵੀ ਵੀਡੀਓ ਕੋਲ ਅਤੇ ਵੀਡੀਓ ਕੋਲਿੰਗ ਅਤੇ ਔਡੀਓ ਕੋਲਿੰਗ ਹੋ ਸਕਦੀ ਸੀ ਅਤੇ ਇਸ ਫੋਨ ਦੀ ਇੱਕ ਸਭ ਤੋਂ ਵੱਡੀ ਡਰੋਅਬੈਕ ਹੈ ਕਿਉਂਕਿ ਜਦੋਂ ਫੋਨ ਨਹੀਂ ਹੁੰਦੇ ਸੀ ਤਾਂ ਅਸੀਂ ਆਪਣੇ ਘਰਦਿਆਂ ਨਾਲ ਟਾਈਮ ਸਪੈਂਡ ਕਰ ਪਾਉਂਦੇ ਸੀ ਹੁਣ ਤਾਂ ਫੋਨ ਹੱਥਾਂ 'ਚ ਲੈ ਕੇ ਬਹਿ ਜਾਂਦੇ ਆ ਅਤੇ ਘਰਦੇ ਆਪਣਾ ਕਰੀ ਜਾਂਦੇ ਕੰਮ ਅਸੀਂ ਆਪਣਾ ਫੋਨਾਂ 'ਤੇ ਦੇਖੀ ਜਾਂਦੇ ਹਾਂ ਇੰਨੇ ਜ਼ਿਆਦਾ ਸੋਸ਼ਲ ਮੀਡੀਆ 'ਤੇ ਐਕਟਿਵ ਹੋ ਗਏ ਹਾਂ ਅਤੇ ਪਹਿਲਾਂ ਇਹ ਹੁੰਦਾ ਸੀ ਕਿ ਆਪਣੇ ਘਰਦਿਆਂ ਨਾਲ ਬੈਠ ਕੇ ਟੀਵੀ ਦੇਖਦੇ ਸੀ ਉਹਨਾਂ ਨਾਲ ਟਾਈਮ ਸਪੈਂਡ ਕਰਦੇ ਸੀ ਹੁਣ ਹੁਣ ਆਪਣੇ ਫੋਨ 'ਤੇ ਟਾਈਮ ਸਪੈਂਡ ਕਰਦੇ ਹਾਂ ਅਤੇ ਸਾਨੂੰ ਐਵੇਂ ਲੱਗਦਾ ਕਿ ਅਸੀਂ ਦੁਨੀਆਂ ਨੂੰ ਮੁੱਠੀ ਵਿੱਚ ਲੈ ਲਿਆ ਅਤੇ ਇਹ ਚੰਗੀ ਗੱਲ ਨਹੀਂ ਹੈ ਕਿਉਂਕਿ ਸਮਾਰਟ ਫੋਨ ਦੇਖਣੇ ਨੂੰ ਵੀ ਵਧੀਆ ਲੱਗਦਾ ਪਰ ਇਹਦੇ ਨੁਕਸਾਨ ਬਹੁਤ ਜ਼ਿਆਦਾ ਨੇ ਪਹਿਲਾਂ ਪਹਿਲਾਂ ਤਾਂ ਬਹੁਤ ਵਧੀਆ ਲੱਗਦਾ ਪਰ ਹੌਲੀ ਹੌਲੀ ਫਿਰ ਬੰਦੇ ਨੂੰ ਇਹ ਨੁਕਸਾਨ ਪਹੁੰਚਾਈ ਜਾਂਦਾ ਏ ਇਸ ਕਰਕੇ ਸਮਾਰਟ ਫੋਨ ਦੇ ਜ਼ਿਆਦਾ ਫਾਇਦੇ ਨਹੀਂ ਹਨ